ਮੈਂ ਆਪਣੀ ਤਾਂ ਜ਼ਿੰਦਗੀ ਅੰਦਰ ਸ਼ਿਮਲੇ ਅਤੇ ਹਰਿਮੰਦਰ ਸਾਹਿਬ ਆਪਣਾ ਗਿਆ ਸ਼ਿਮਲੇ ਦੇ ਅੰਦਰ ਵਾਤਾਵਰਨ ਬਹੁਤ ਵਧੀਆ ਹੈ ਜਾਣੀ ਕਿ ਉੱਥੇ ਇੱਕ ਤਾਂ ਸਫਾਈ ਹੈ ਅਤੇ ਇੱਕ ਉੱਥੇ ਜਾ ਕੇ ਜਿਹੜੀ ਮਨ ਨੂੰ ਸ਼ਾਂਤੀ ਮਿਲਦੀ ਹੈ ਜਾਣੀ ਕਿ ਮਾਹੌਲ ਬਹੁਤ ਵਧੀਆ ਹੈ ਰੋਟੀ ਪਾਣੀ ਅੱਛਾ ਵੀ ਵਧੀਆ ਤਾਂ ਉੱਥੇ ਵਾਤਾਵਰਨ ਬਹੁਤ ਅੱਛਾ ਵੀ ਵਧੀਆ ਜਾਣੀ ਕਿ ਉਹ ਜਿਹੜੇ ਲੋਕ ਨੇ ਉਹ ਉੱਧਰ ਦੇ ਲੋਕ ਵੀ ਆਪਣਾ ਸ਼ਾਂਤਮਈ ਨੇ ਅਤੇ ਉਹ ਮੈਨੂੰ ਬਹੁਤ ਵਧੀਆ ਆਪਣਾ ਲੱਗਿਆ ਇਸ ਤੋਂ ਇਲਾਵਾ ਹਰਿਮੰਦਰ ਸਾਹਿਬ ਗੋਲਡਨ ਆਪਣਾ ਇਹ ਟੈਂਪਲ ਸਰੋਵਰ ਉਹ ਚੀਜ਼ਾਂ ਵੀ ਮੇਰੇ ਮਨ 'ਤੇ ਬਹੁਤ ਵਧੀਆ ਨੇ ਅਤੇ ਇਹ ਜੋ ਮੇਰੀਆਂ ਆਪਣਾ ਘੁੰਮਣ ਦੀਆਂ ਮਕ ਕਿ ਆਪਣਾ ਥਾਵਾਂ ਨੇ ਇਹ ਮੈਨੂੰ ਥਾਵਾਂ ਬਹੁਤ ਵਧੀਆ ਹੀ ਆਪਣਾ ਲੱਗੀਆਂ